ਇਹ ਫੈਸਲਾ ਕਰਨਾ ਬਹੁਤ ਹੀ ਸੌਖਾ ਹੈ ਕਿ ਸਾਡੇ ਬਾਗ ਦੇ ਵਿੱਚ ਕਿਹੜੇ ਤਰ੍ਹਾਂ ਦੇ ਪੌਦਿਆਂ ਨੂੰ ਉਗਾਉਣਾ ਹੈ ਮੌਸਮ ਦੇ ਹਿਸਾਬ ਨਾਲ ਜ਼ਿਆਦਾਤਰ ਪੌਦਿਆਂ ਨੂੰ ਉਗਾਇਆ ਜਾਂਦਾ ਹੈ ਜਿਵੇਂ ਜਿਸ ਪ੍ਰਕਾਰ ਦਾ ਮੌਸਮ ਹੁੰਦਾ ਉਸ ਪ੍ਰਕਾਰ ਦੀ ਸਬਜ਼ੀਆਂ ਅਤੇ ਫਲ ਬੀਜਦੇ ਹਾਂ ਅਸੀਂ ਜਿਵੇਂ ਕਿ ਗਰਮੀਆਂ ਦੇ ਵਿੱਚ ਜਿਹੜੀ ਵੀ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਜਿਵੇਂ ਮਟਰ ਕਰੇਲੇ ਅਤੇ ਪਹਾੜੀਆਂ ਮਿਰਚਾ ਇਹ ਅਸੀਂ ਉਗਾਉਂਦੇ ਹਾਂ ਅਤੇ ਸਰਦੀਆਂ ਦੇ ਵਿੱਚ ਗਾਜਰ ਮੂਲੀ ਇੱਦਾਂ ਦੀਆਂ ਉਗਾਈਆਂ ਜਾਂਦੀਆਂ ਹਨ ਤਾਂ ਮੌਸਮ ਦੇ ਹਿਸਾਬ ਨਾਲ ਅਸੀਂ ਇਹ ਵੇਖ ਕੇ ਉਗਾਉਂਦੇ ਹਾਂ ਪਰ ਕਦੇ ਕਦੇ ਜਿਵੇਂ ਕਿ ਗਰਮੀਆਂ ਦੇ ਵਿੱਚ ਨਿੰਬੂਆਂ ਦੀ ਜਾਂ ਫਿਰ ਟਮਾਟਰਾਂ ਦੀ ਸੇਲ ਵੱਧ ਜਾਂਦੀ ਹੈ ਤਾਂ ਅਸੀਂ ਉਹ ਵੀ ਉਗਾ ਕੇ ਵੇਚ ਦਿੰਦੇ ਹਾਂ ਇਹ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ ਕਿਉਂਕਿ ਉਹਦੇ ਜਿਹੜੇ ਰੇਟ ਹੈ ਉਹ ਵੀ ਵਾਧੂ ਹੁੰਦੇ ਹਨ ਅਤੇ ਸਾਨੂੰ ਬਹੁਤ ਹੀ ਮੁਨਾਫਾ ਹੁੰਦਾ ਹੈ ਕਦੇ ਕਦੇ ਸ ਸੀਜ਼ਨ ਦੇ ਵਿੱਚ ਜਿਹੜੇ ਸ ਪੌਦੇ ਬੀਜੇ ਜਾਂਦੇ ਹਨ ਉਹ ਨਹੀਂ ਉੱਗ ਪਾਉਂਦੇ ਪਰ ਫਿਰ ਵੀ ਅਸੀਂ ਦੁਬਾਰਾ ਉਹਨਾਂ ਨੂੰ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਹ ਚੰਗੀ ਤਰ੍ਹਾਂ ਉੱਗ ਜਾਣ ਅਤੇ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਾਂ